ਹੈਲੋ ਹਾਂਜੀ ਭਾਅ ਜੀ ਤੁਸੀਂ ਸਵਿੱਗੀ ਤੋਂ ਬੋਲ ਰਹੇ ਹੋ ਹਾਂਜੀ ਹਾਂਜੀ ਹਾਂਜੀ ਭਾਅ ਜੀ ਮੈਂ ਨਾ ਰਣਜੀਤ ਸਿੰਘ ਬੋਲ ਰਿਹਾ ਡੀ ਡੀ ਮਿੱਤਲ ਟਾਵਰ ਤੋਂ ਹਾਂਜੀ ਹਾਂਜੀ ਭਾਅ ਜੀ ਆਪਾਂ ਨਾ ਖਾਣਾ ਆਡਰ ਕਰਨਾ ਸੀਗਾ ਦਸ ਬਾਰਾਂ ਬੰਦਿਆਂ ਲਈ ਹਾਂਜੀ ਖਾਣੇ 'ਚ ਆਪਾਂ ਨੂੰ ਭਾਅ ਜੀ ਇੱਕ ਸ਼ਾਹੀ ਪਨੀਰ ਅਤੇ ਰੋਟੀਆਂ ਅਤੇ ਸਲਾਦ ਅਤੇ ਲੱਸੀ ਭੇਜ ਦਿਓ ਹਾਂਜੀ ਹਾਂਜੀ ਹਾਂਜੀ ਭਾਅ ਜੀ ਲਾਸਟ ਟਾਈਮ ਨਾ ਤੁਹਾਡਾ ਇੱਕ ਜਿਹੜਾ ਤੁਸੀਂ ਭੇਜਿਆ ਸੀਗਾ ਬੰਦਾ ਆਪਣਾ ਡਿਲੀਵਰੀ ਬੋਆਏ ਉਹ ਕਿਸੇ ਹੋਰ ਗਲਤ ਜਗ੍ਹਾ 'ਤੇ ਪਹੁੰਚ ਗਿਆ ਸੀਗਾ ਅੱਜ ਨਾ ਪ੍ਰੋਪਰ ਤਰੀਕੇ ਨਾਲ ਮੇਰਾ ਐਡਰੈਸ ਨੋਟ ਕਰ ਲਿਓ ਮੇਰਾ ਐਡਰੈਸ ਹੈਗਾ ਡੀ ਡੀ ਮਿੱਤਲ ਟਾਵਰ ਮਕਾਨ ਨੰਬਰ ਦੋ ਸੌ ਅੱਠ ਸੈਕਿੰਡ ਫਲੋਰ 'ਤੇ ਹੈ ਹਾਂਜੀ ਭਾਅ ਜੀ ਹਾਂਜੀ ਹਾਂਜੀ ਅਤੇ ਭਾਅ ਜੀ ਜਲਦੀ ਕਰਿਓ ਥੋੜ੍ਹਾ ਜਿੰਨਾ ਹੋ ਸਕੇ ਹੈ ਨਾ ਕਿਉਂਕਿ ਇੰਨਾ ਵੇਟ ਨਹੀਂ ਹੋ ਸ ਹੋ ਪਾਉਂਦਾ ਹਾਂਜੀ ਹਾਂਜੀ ਠੀਕ ਹੈ ਭਾਅ ਜੀ ਓਕੇ ਥੈਂਕ ਯੂ ਭਾਅ ਜੀ